ਹੈਲੋ ਸਰ ਸਤਿ ਸ਼੍ਰੀ ਅਕਾਲ ਸਰ ਮੈਂ ਮੈਰਿਜ 'ਤੇ ਜਾਣਾ ਵਾਂ ਇਕ ਸੌ ਤੇਰਾ ਮਾਡਲ ਟਾਊਨ 'ਤੇ ਸਰ ਮੇਰਾ ਮੈਰਿਜ 'ਤੇ ਨਾ ਜਲਦੀ ਪਹੁੰਚਣਾ ਵਾ ਮੈਂ ਕਿਉਂਕਿ ਮੈਂ ਲੇਟ ਨਹੀਂ ਹੋਣਾ ਚਾਹੁੰਦੀ ਅਤੇ ਤੁਸੀਂ ਜਲਦੀ ਆ ਸਕਦੇ ਹੋ ਤਾਂ ਜੋ ਸਰ ਮੈਂ ਟਾਈਮ ਸਿਰ ਪਹੁੰਚ ਸਕਾਂ ਕਿਉਂਕਿ ਉੱਥੇ ਪਹਿਲਾਂ ਤੋਂ ਹੀ ਗੈਸਟ ਆ ਚੁੱਕੇ ਆ ਅਤੇ ਮੈਂ ਅੱਗੇ ਹੀ ਲੇਟ ਹਾਂ ਮੇਰਾ ਮੈਰਿਜ 'ਤੇ ਟਾਈਮ ਸਿਰ ਸਰ ਪਹੁੰਚਣਾ ਬਹੁਤ ਜ਼ਰੂਰੀ ਆ ਕਿਉਂਕਿ ਮੇਰੇ ਕਜ਼ਨ ਦੀ ਮੈਰਿਜ ਆ ਅਤੇ ਸਰ ਤੁਸੀਂ ਜਲਦੀ ਆ ਸਕਦੇ ਹੋ ਤੁਸੀਂ ਸੱਤ ਕੁ ਵਜੇ ਦੇ ਨੀਅਰ ਅਬਾਉਟ ਸਰ ਮੇਰੇ ਘਰ ਦੇ ਕੋਲ ਆ ਜਾਇਓ ਅਤੇ ਉੱਥੇ ਹੀ ਸਰ ਮੈਨੂੰ ਜਿਹੜਾ ਪਿਕਅਪ ਕਰ ਲਿਓ ਅਤੇ ਤਾਂ ਜੋ ਮੈਂ ਟਾਈਮ ਸਿਰ ਉੱਥੇ ਪਹੁੰਚ ਸਕਾ ਕਿਉਂਕਿ ਮੈਂ ਲੇਟ ਨਹੀਂ ਹੋਣਾ ਚਾਹੁੰਦੀ ਅੱਗੇ ਮੈਨੂੰ ਮੋਮ ਦੀਆਂ ਕੋਲਸ ਆਈ ਜਾ ਰਹੀਆਂ ਵਾਂ ਕਿ ਤੂੰ ਹਲੇ ਤੱਕ ਉੱਥੇ ਪਹੁੰਚੀ ਨਹੀਂ ਹੈਗੀ ਪਰ ਮੈਂ ਮੋਮ ਨੂੰ ਮੈਂ ਕੀ ਦੱਸਾ ਮੈਂ ਅੱਗੇ ਬਹੁਤ ਜ਼ਿਆਦਾ ਲੇਟ ਹੋ ਚੁੱਕੀ ਹਾਂ ਸਰ ਸੱਤ ਵਜੇ ਨੀਅਰ ਅਬਾਉਟ ਮੈਨੂੰ ਕੀ ਕਹਿੰਦੇ ਤੁਸੀਂ ਪਿਕਅਪ ਕਰ ਲਿਓ ਮੇਰੇ ਘਰ ਦੇ ਲਾਗੋ ਹੀ ਅਤੇ ਸਰ ਆਪਣਾ ਨੇਮ ਦੱਸ ਦਿਓ ਅਤੇ ਇਹ ਵੀ ਦੱਸ ਦਿਓ ਕਿ ਤੁਸੀਂ ਕ ਸਰ ਕਿੰਨੇ ਕੁ ਟਾਈਮ ਤੱਕਰ ਆ ਸਕਦੇ ਹੋ ਆਪਣੀ ਲੋਕੇਸ਼ਨ ਹੈਗੀ ਆ ਉਹ ਮੈਨੂੰ ਸੈਂਡ ਕਰ ਦਿਓ ਕਿ ਤਾਂ ਜੋ ਮੈਨੂੰ ਪਤਾ ਲੱਗ ਸਕੇ ਕਿ ਸਰ ਤੁਸੀਂ ਹੈ ਕਿੱਥੇ ਹੋ ਅਸਲ 'ਚ ਸਰ ਮੈਂ ਇਕ ਸੌ ਤੇਰਾ ਮਾਡਲ ਟਾਊਨ ਜਾਣਾ ਵਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਨਾ ਨਹੀਂ ਤਾਂ ਮੈਂ ਬਹੁਤ ਜ਼ਿਆਦਾ ਲੇਟ ਹੋ ਜਾਣਾ ਉੱਥੇ ਮੈਰਿਜ 'ਤੇ ਪਹੁੰਚਣ ਵਾਸਤੇ ਇਸ ਕਰਕੇ ਪੁੱਛ ਰਹੀ ਹਾਂ ਕਿ ਆਪਣੀ ਲੋਕੇਸ਼ਨ ਵਗੈਰਾ ਵਾ ਉਹ ਮੈਨੂੰ ਸੈਂਡ ਕਰ ਦਿਓ ਕਿ ਤਾਂ ਜੋ ਤੁਹਾਨੂੰ ਮੈਂ ਟਰੈਕ ਕਰ ਸਕਾਂ ਹਜੇ ਤੁਸੀਂ ਕਿੱਥੇ ਕੁ ਪਹੁੰਚ ਗਏ ਹੋ ਸਰ ਤੁਸੀਂ ਮੈਨੂੰ ਕਾਲ ਕਰ ਦਿਓ ਕਿ ਜਦੋਂ ਤੁਸੀਂ ਪਹੁੰਚ ਗਏ ਠੀਕ ਆ ਸਰ ਓਕੇ ਸਰ ਥੈਂਕ ਯੂ